ਸਭ ਤੋਂ ਮਜ਼ੇਦਾਰ ਤਜ਼ਰਬਾ ਮੇਰਾ ਉਸ ਸਮੇਂ ਹੋਇਆ ਜਦ ਮੈਂ ਆਪਣੀ ਬੇਟੀ ਦਾ ਬਰਡੇ ਸੈਲੀਬ੍ਰੇਟ ਕੀਤਾ ਅਤੇ ਉਹਦੇ ਨਾਨਾ ਨਾਨੀ ਨੇ ਆਉਣਾ ਸੀਗਾ ਉਹਨਾਂ ਦੀ ਜੁਆਇੰਟ ਫੈਮਲੀ ਸੀਗੀ ਅਤੇ ਸਾਰੇ ਦਸ ਗਿਆਰ੍ਹਾਂ ਮੈਂਬਰਸ ਉਹਨਾਂ ਦੇ ਸੀਗੇ ਛੇ ਸੱਤ ਮੈਂਬਰ ਸਾਡੇ ਘਰ ਦੇ ਸੀਗੇ ਤਾਂ ਸਭ ਤੋਂ ਵੱਡਾ ਸੀਗਾ ਅਤੇ ਅਸੀਂ ਉਹਨਾਂ ਨੂੰ ਰੋਟੀ 'ਤੇ ਇਨਵਾਈਟ ਕੀਤਾ ਅਤੇ ਸ਼ਾਮੀ ਆਏ ਅਤੇ ਅਸੀਂ ਸਾਡਾ ਮੇਨ ਟਾਸਕ ਆ ਕਿ ਮੈਨਯੂ ਕੀ ਡਿਸਾਈਡ ਕਰੀਏ ਸਭ ਤੋਂ ਪਹਿਲਾਂ ਆਪਾਂ ਮੈਨਯੂ ਡਿਸਾਈਡ ਕੀਤਾ ਜਿਹਦੇ 'ਚ ਆਪਾਂ ਰੱਖਿਆ ਕਿ ਆਪਾਂ ਰਾਜਮਾਂਹ ਚਾਵਲ ਰਾਜਮਾਂਹ ਬਣਾਵਾਂਗੇ ਚਾਵਲ ਦਾ ਅਸੀਂ ਥੋੜ੍ਹਾ ਰੱਖੀਏ ਚਾਵਲ ਬਣਾਵਾਂਗੇ ਅਤੇ ਮਿਕਸ ਵੈੱਜ ਬਣਾਏ ਅਤੇ ਉਹਦੇ ਵਾਸਤੇ ਫਿਰ ਸਾਨੂੰ ਅਸੀਂ ਮਾਰਕਿਟ ਗਏ ਮਾਰਕਿਟ ਦੇ ਵਿੱਚ ਫਿਰ ਰਾਜਮਾਂਹ ਬਾਏ ਕੀਤੀ ਫਿਰ ਸਬਜ਼ੀ ਮੰਡੀ ਜਾ ਕੇ ਫਿਰ ਅਲੱਗ ਅਲੱਗ ਮਿਕਸ ਵੈੱਜ ਬਾਏ ਕੀਤੀ ਸ਼ਿਮਲਾ ਮਿਰਚ ਹੋ ਗਿਆ ਗੋਭੀ ਹੋ ਗਈ ਕਮਲ ਡੰਡੀ ਹੋ ਗਈ ਕਾਫ਼ੀ ਚਾਰ ਪੰਜ ਐਟਮਾਂ ਆਪਾਂ ਲੈ ਕੇ ਮਟਰ ਵਗੈਰਾ ਸਾਰਾ ਕੁਝ ਲੈ ਕੇ ਆਏ ਫਿਰ ਉਹਨੂੰ ਫਰਾਈ ਕੀਤਾ ਅਸੀਂ ਸਾਰਾ ਕੁਝ ਉਹਦੀ ਪ੍ਰਪਰੇਸ਼ਨ ਕੀਤੀ ਥੋੜ੍ਹਾ ਜਿਹਾ ਹੋਇਆ ਕਿ ਸਾਡੇ ਰਾਜਮਾਂਹ ਵਿੱਚ ਥੋੜ੍ਹਾ ਜਿਹਾ ਨਮਕ ਜ਼ਿਆਦਾ ਪੈ ਗਿਆ ਸੀਗਾ ਸਾਨੂੰ ਉਹਦੀ ਪਰੋ ਫਿਰ ਬਾਅਦ 'ਚ ਪਤਾ ਲੱਗਾ ਨਮਕ ਜ਼ਿਆਦਾ ਹੋ ਗਿਆ ਫਿਰ ਅਲੱਗ ਅਲੱਗ ਐਕਸਪੈਰੀਮੈਂਟ ਕੀਤੇ ਗਏ ਉਹਦੇ 'ਤੇ ਸਭ ਤੋਂ ਪਹਿਲਾਂ ਫਿਰ ਉਹਦੇ 'ਚ ਆਟੇ ਦੇ ਪੇੜੇ ਪਾ ਕੇ ਕਿਤੇ ਕਿ ਨਮਕ ਦੀ ਕੁਐਂਟਟੀ ਘੱਟ ਹੋਜੇ ਅਤੇ ਥੋੜ੍ਹਾ ਜਿਹਾ ਫ਼ਰਕ ਪੈਂਦਾ ਆ ਪਰ ਬਹੁਤ ਜ਼ਿਆਦਾ ਰਿਜ਼ਲਟ ਅੱਛਾ ਨਹੀਂ ਲੱਗਾ ਆਇਆ ਫਿਰ ਅਸੀਂ ਥੋੜ੍ਹਾ ਜਿਹਾ ਉਹਨੂੰ ਹੋਰ ਵਧਾ ਕੇ ਕੀਤਾ ਕਿ ਤਾਂ ਕਿ ਚਲੋ ਨਮਕ ਦੀ ਕੁਐਂਟਟੀ ਘੱਟ ਹੋਏ ਲਾਸਟ ਦੇ ਵਿੱਚ ਨਮਕ ਦੀ ਕੁਐਂਟਟੀ ਘੱਟ ਹੋਈ ਫਿਰ ਸਾਨੂੰ ਰਿਲਾਇਜ਼ ਹੋਇਆ ਕਿ ਅਸੀਂ ਮਿੱਠਾ ਨਹੀਂ ਬਣਾਇਆ ਫਿਰ ਆਪਾਂ ਓਨ ਦਾ ਸਪੋਟ ਉਹਨਾਂ ਦੇ ਵਾਸਤੇ ਕੜਾਹ ਬਣਾਇਆ ਜੋ ਕਿ ਬਹੁਤ ਮੇਰੇ ਫਾਦਰ ਸਾਹਿਬ ਨੇ ਬਹੁਤ ਅੱਛਾ ਬਣਾਇਆ ਅਸੀਂ ਮਿਲ ਕੇ ਬਣਾਇਆ ਸਾਰਿਆਂ ਨੇ ਅਤੇ ਲਾਸਟ ਦੇ ਵਿੱਚ ਫਿਰ ਸਾਡੇ ਰਾਜਮਾਂਹ ਜਿੱਦਾਂ ਆਪਾਂ ਦੱਸਿਆ ਕਿ ਜ਼ਿਆਦਾ ਬਣ ਗਏ ਸੀਗੇ ਅਤੇ ਫਿਰ ਉਹਨਾਂ ਦੀ ਜੁਆਇੰਟ ਫੈਮਲੀ ਹੈਗੀ ਏ ਨੈਚੁਰਲ ਉਹਨਾਂ ਦੇ ਯੂਜ ਹੋ ਜਾਣੇ ਸੀਗੇ ਲਾਸਟ ਦੇ ਵਿੱਚ ਫਿਰ ਆਪਾਂ ਸਾਰੇ ਹਾਫ਼ ਕਰਕੇ ਉਹਨਾਂ ਨੂੰ ਬਰਡੇ ਸੈਲੀਬ੍ਰੇਟ ਕੀਤਾ ਖਾਣਾ ਖਾਇਆ ਉਹਨਾਂ ਨੂੰ ਖਾਣਾ ਬਹੁਤ ਅੱਛਾ ਲੱਗਾ ਜੋ ਜੋ ਸਾਡਾ ਸਮਾਨ ਬੱਚ ਗਿਆ ਅਸੀਂ ਫਿਰ ਅੱਧਾ ਉਹਨਾਂ ਨੂੰ ਇੱਦਾਂ ਵੀ ਦੇ ਤਾ ਕਿ ਚਲੋ ਸਾਡੇ ਤਾਂ ਯੂਜ ਨਹੀਂ ਹੋਣਾ ਆਪਾਂ ਵੇਸਟੇਜ਼ ਨਹੀਂ ਕਰਨੀ ਕਿਸੇ ਤਰ੍ਹਾਂ ਦੀ ਪਰ ਸਾਨੂੰ ਬਹੁਤ ਅੱਛਾ ਲੱਗਾ ਪਰ ਉਹਨਾਂ ਨੂੰ ਵੀ ਬਹੁਤ ਅੱਛਾ ਲੱਗਾ ਕਿ ਖਾਣੇ ਦੀ ਕਿੰਨੀ ਕਦਰ ਕਰਦੇ ਹੈਗੇ ਵੇਸਟੇਜ਼ ਨਹੀਂ ਕਰਦੇ ਪਰ ਕਿਉਂਕਿ ਖਾਣਾ ਬਹੁਤ ਕਿਸਮਤ ਨਾਲ਼ ਮਿਲਦਾ ਆ ਰੋਟੀ ਬਹੁਤ ਮੁਸ਼ਕਿਲ ਨਾਲ਼ ਮਿਲਦੀ ਹੈ ਅਤੇ ਉਹਨਾਂ ਨੂੰ ਸਾਡੀ ਇਹ ਚੀਜ਼ ਵੀ ਬਹੁਤ ਅੱਛੀ ਲੱਗੀ ਅਤੇ ਉਹਨਾਂ ਨੂੰ ਸਾਡੀ ਪ੍ਰੇਪਰੇਸ਼ਨ ਬਹੁਤ ਅੱਛੀ ਲੱਗੀ ਸਾਡਾ ਖਾਣਾ ਬਹੁਤ ਅੱਛਾ ਲੱਗਾ ਅਤੇ ਬੇਟੀ ਦਾ ਬਰਡੇ ਬਹੁਤ ਅੱਛੀ ਤਰ੍ਹਾਂ ਸੈਲੀਬ੍ਰੇਟ ਕੀਤਾ ਇੱਕ ਉਹ ਅੱਛੀ ਜਿਹੀ ਮੈਮਰੀ ਜੇ ਆਪਾਂ ਫਸਟ ਟਾਈਮ ਨੂੰ ਇਨਵਾਈਟ ਕੀਤਾ ਸੀਗਾ ਮੇਰੀ ਬੇਟੀ ਦਾ ਫਸਟ ਬਰਡੇ ਸੀਗਾ ਅਤੇ ਖਾਣੇ 'ਤੇ ਇਨਵਾਈਟ ਕੀਤਾ ਅਤੇ ਉਹ ਖਾਣਾ ਔਰ ਉਹ ਸਭ ਚੀਜ਼ਾਂ ਜੋ ਆਪਾਂ ਇੱਕ ਫੋਟੋ ਦੇ ਵਿੱਚ ਖਿੱਚ ਕੇ ਰੱਖੀਆਂ ਹੋਈਆਂ ਆਪਣੇ ਕੋਲ ਅਤੇ ਬਹੁਤ ਅੱਛਾ ਲੱਗਾ ਅਤੇ ਪਿਆਰ ਮੈਨੂੰ ਲੱਗਦਾ ਹੈ ਕਿ ਬਾਹਰੋਂ ਲਿਆਉਣ ਨਾਲ਼ੋਂ ਵਧੀਆ ਬੰਦਾ ਆਪ ਹੱਥੀਂ ਬਣਾ ਕੇ ਖਵਾਵੇ ਕਿਸੇ ਨੂੰ ਤਾਂ ਜ਼ਿਆਦਾ ਸਵਾਦ ਆਉਂਦਾ ਆ ਨਾਲ਼ੇ ਬਰਕਤ ਵੀ ਰਹਿੰਦੀ ਆ ਅਤੇ ਬਹੁਤ ਅੱਛੇ ਐਕਸਪੀਰੀਐਂਸ ਅਤੇ ਇਸ ਐਸਾ ਐਕਸਪੀਰੀਐਂਸ ਮੇਰਾ ਲਾਈਫ ਦਾ ਸਭ ਤੋਂ ਬੈੱਸਟ ਐਕਸਪੀਰੀਐਂਸ ਸੀਗਾ ਅਤੇ ਬੱਚੇ ਵੀ ਬਹੁਤ ਖੁਸ਼ ਸੀਗੇ ਸਾਰੇ ਬਹੁਤ ਖੁਸ਼ ਸੀਗੇ ਅਤੇ ਬੱਚਿਆਂ ਨੂੰ ਵੀ ਖਾਣਾ ਬਹੁਤ ਅੱਛਾ ਲੱਗਾ